ਜੇਕਰ ਅਸੀਂ ਅੱਜ ਦੇ ਪੰਜਾਬ ਨੂੰ ਦੇਖੀਏ ਤਾਂ ਅੱਜ ਦੇ ਪੰਜਾਬ ਦੇ ਵਿੱਚ ਵਪਾਰਕ ਖੇਤਰ ਬਹੁਤ ਜ਼ਿਆਦਾ ਵਧੇ ਹਨ ਵਪਾਰਕ ਖੇਤਰ ਵਧਣ ਦੇ ਨਾਲ ਇੱਥੋਂ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਵੀ ਹੋਇਆ ਹੈ ਜਿਵੇਂ ਕਿ ਉਹਨਾਂ ਦੀ ਬੇਰੁਜ਼ਗਾਰੀ ਵਿੱਚ ਕਮੀ ਹੋਈ ਹੈ ਪਹਿਲਾਂ ਪੰਜਾਬ ਦੇ ਵਿੱਚ ਜੇ ਦੇਖਿਆ ਜਾਏ ਤਾਂ ਜ਼ਿਆਦਾਤਰ ਲੋਕ ਖੇਤੀਬਾੜੀ 'ਤੇ ਨਿਰਭਰ ਸਨ ਪਰੰਤੂ ਜੇ ਪਰੰਤੂ ਹੁਣ ਜੇਕਰ ਦੇਖਿਆ ਜਾਏ ਤਾਂ ਵਪਾਰਕ ਖੇਤਰ ਆਏ ਹਨ ਵਪਾਰਕ ਖੇਤਰ ਆਨ ਦੇ ਨਾਲ ਉਹ ਲੋਕ ਉਹਨਾਂ ਦੇ ਵਿੱਚ ਕੰਮ ਕਰਨ ਲੱਗੇ ਹਨ ਅਤੇ ਉਹਨਾਂ ਦਾ ਕਿਆ ਹੈ ਜਿਹੜੇ ਉਹਨਾਂ ਦਾ ਰਹਿਣਾ ਸਹਿਣਾ ਹੈ ਰਹਿਣਾ ਸਹਿਣੇ ਦੇ ਵਿੱਚ ਤਬਦੀਲੀ ਆਈ ਹੈ ਇਸ ਤਰ੍ਹਾਂ ਕਿਆ ਹੈ ਜਿਹੜੇ ਉੱਥੋਂ ਦੇ ਲੋਕ ਆ ਉਹਨਾਂ ਦਾ ਮਤਲਬ ਉਹਨਾਂ ਨੂੰ ਉਹਨਾਂ ਨੇ ਸੰਬੋਧਿਤ ਕੀਤਾ ਹੈ ਅਤੇ ਸੰਬੋਧਿਤ ਕਰਨ ਦੇ ਨਾਲ ਕਿਆ ਹੈ ਉਹਨਾਂ ਦੇ ਪਹਿਰਾਵੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦੀ ਇੱਕ ਪ ਖੇਤੀਬਾੜੀ ਵਾਲੇ ਲੈਵਲ ਤੋਂ ਉਹ ਉੱਪਰ ਚੁੱਕ ਕੇ ਆਪਣਾ ਮਤਲਬ ਰਹਿਣਾ ਸਹਿਣਾ ਵਧੀਆ ਢੰਗ ਨਾਲ ਬਤੀਤ ਕਰਨ ਲੱਗੇ ਪਰੰਤੂ ਵਪਾਰਕ ਖੇਤਰ ਪੰਜਾਬ ਦੇ ਵਿੱਚ ਵਧਣ ਦੇ ਨਾਲ ਕੁਝ ਵਾਤਾਵਰਣਿਕ ਤਬਦੀਲੀਆਂ ਵੀ ਆਈਆਂ ਹਨ ਜਿਵੇਂ ਕਿ ਪਹਿਲਾਂ ਜਿਹੜੇ ਵਪਾਰਕ ਖੇਤਰ ਹੁੰਦੇ ਸੀ ਇਹ ਦੂਰ ਦੂਰ ਹੁੰਦੇ ਸੀ ਜਿਸ ਦੇ ਕਾਰਨ ਜਿਹੜਾ ਪੰਜਾਬ ਦਾ ਵਾਤਾਵਰਣ ਹੈ ਇਹ ਬਹੁਤ ਵਧੀਆ ਹੁੰਦਾ ਸੀ ਪਰੰਤੂ ਹੁਣ ਜੇਕਰ ਦੇਖਿਆ ਜਾਏ ਵਪਾਰਕ ਖੇਤਰ ਵਧਣ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪ੍ਰਦੂਸ਼ਣ ਹੋ ਰਿਹਾ ਹੈ ਜਿਵੇਂ ਕਿ ਫੈਕਟਰੀਆਂ ਹੋ ਗਈਆਂ ਫੈਕਟਰੀਆਂ ਵਿੱਚੋਂ ਨਿਕਲ ਰਹੀਆਂ ਗੰਦੀਆਂ ਗੈਸਾਂ ਗੰਦੀਆਂ ਗੰਦਾ ਧੂੰਆਂ ਗੰਦਾ ਪਾਣੀ ਉਹ ਜੇਕਰ ਜੇਕਰ ਇੱਕ ਜਿਹੜਾ ਜਿਹੜੀ ਇੱਕ ਫੈਕਟਰੀ ਆ ਜੇਕਰ ਉਹ ਕਿਸੇ ਪਿੰਡ ਦੇ ਵਿੱਚ ਲੱਗੀ ਹੋਈ ਹੈ ਤਾਂ ਤਾਂ ਜਿਹੜਾ ਉਹ ਗੰਦਾ ਪਾਣੀ ਛੱਡ ਰਹੀ ਹੈ ਅਤੇ ਗੰਦੀਆਂ ਗੈਸਾਂ ਛੱਡ ਰਹੀ ਹੈ ਤਾਂ ਉਹ ਉਸ ਪਿੰਡ ਦਾ ਜਿਹੜਾ ਵਾਤਾਵਰਣ ਹੈ ਉਹ ਗੰਦਾ ਹੋ ਰਿਹਾ ਹੈ ਗੰਦਾ ਹੋਣ ਦੇ ਨਾਲ ਜਿਹੜੇ ਉੱਥੇ ਦੇ ਲੋਕ ਰਹਿ ਰਹੇ ਹਨ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਉੱਥੋਂ ਦੇ ਲੋਕਾਂ ਨੂੰ ਕਿਆ ਇਹ ਜਿਹੜੀਆਂ ਹੈਗੀਆਂ ਸਾਹ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ ਪਾਣੀ ਪੀਣ ਦੇ ਨਾਲ ਪਾਣੀ ਦੇ ਕਾਰਨ ਉਹਨਾਂ ਨੂੰ ਸਰੀਰ ਦੇ ਅੰਦਰ ਬਹੁਤ ਪਰੇਸ਼ਾਨੀਆਂ ਹੋ ਰਹੀਆਂ ਹਨ ਅਤੇ ਸਾਹ ਦੇ ਦੇ ਰੋਗ ਲੱਗ ਰਹੇ ਹਨ ਜਿਵੇਂ ਕਿ ਦਮਾ ਅਸਥਮਾ ਇਸ ਤਰ੍ਹਾਂ ਦੀਆਂ ਬਿਮਾਰੀਆਂ ਜੋ ਹੈ ਉਹ ਲੱਗ ਰਹੀਆਂ ਹਨ ਇਸ ਤਰ੍ਹਾਂ ਜਿਹੜਾ ਵਪਾਰਕ ਖੇਤਰ ਹੈ ਉਹਨੇ ਸਾਡੇ ਜਿਹੜੇ ਵਾਤਾਵਰਨ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਹੈਗਾ ਪ੍ਰਭਾਵ ਪਾਇਆ ਹੈ ਜਿਹੜਾ ਵਾਤਾਵਰਨ ਹੈ ਇਸ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਹੈ ਵਪਾਰਕ ਖੇਤਰ ਵਧਣ ਦੇ ਜਿੱਥੇ ਫਾਇਦੇ ਹਨ ਸਾਡੇ ਸਮਾਜ ਨੂੰ ਫਾਇਦੇ ਵੀ ਬਹੁਤ ਹਨ ਕਿਉਂਕਿ ਜੇਕਰ ਹੁਣ ਪਹਿਲਾਂ ਦੇ ਮੁਕਾਬਲੇ ਹੁਣ ਦੇਖਿਆ ਜਾਏ ਤਾਂ ਹੁਣ ਬਹੁਤ ਜ਼ਿਆਦਾ ਲੋਕ ਜਿਹੜੇ ਰੁਜ਼ਗਾਰ ਦੇ ਮਤਲਬ ਰੁਜ਼ਗਾਰ ਪ੍ਰਾਪਤ ਹੋਇਆ ਹੈ ਜਿਨ੍ਹਾਂ ਨੂੰ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹ ਆਪਣੇ ਖੇਤੀਬਾੜੀ ਨੂੰ ਛੱਡ ਕੇ ਖੇਤੀਬਾੜੀ ਤੋਂ ਥੋੜ੍ਹਾ ਉੱਪਰ ਉੱਠ ਕੇ ਹੁਣ ਕਿਆ ਜਿਹੜੀ ਉਹ ਫੈਕਟਰੀਆਂ ਹੈ ਉਹਨਾਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਹਨ ਖੇਤੀਬਾੜੀ ਦਾ ਲੈਵਲ ਥੋੜ੍ਹਾ ਘੱਟ ਗਿਆ ਹੈ ਇਸ ਲਈ ਜਿਹੜਾ ਮਤਲਬ ਉਹਨਾਂ ਦਾ ਰਹਿਣਾ ਸਹਿਣਾ ਤਾਂ ਵਧੀਆ ਹੋਇਆ ਹੀ ਹੈ ਰਹਿਣ ਸਹਿਣ ਦੇ ਨਾਲ ਉਹ ਇੱਕ ਉੱਚ ਪੱਧਰ ਦੀਆਂ ਉਹਨਾਂ ਦੀਆਂ ਜਿਹੜੀਆਂ ਲੋੜਾਂ ਸੀਗੀਆਂ ਉਹ ਵੀ ਪੂਰਤੀ ਹੋਣ ਲੱਗ ਪਈ ਹੈ ਪਰੰਤੂ ਇਸ ਦੇ ਨਾਲ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਵਾਤਾਵਰਨ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਹੋਈ ਹੈ ਜਿਸ ਦੇ ਨਾਲ ਸਾਡਾ ਕਿਆ ਹੈ ਜਿਹੜੀ ਗ੍ਰੀਨਰੀ ਹੈ ਜਿਵੇਂ ਕਿ ਸਾਡੀ ਹਰਿਆਲੀ ਹੈ ਜਿਵੇਂ ਕਿ ਫੈਕਟਰੀ ਲੱਗਦੀ ਹੈ ਜਿੱਦਾਂ ਕਿ ਕਿਸੇ ਸਥਾਨ ਦੇ ਉੱਤੇ ਫੈਕਟਰੀ ਲੱਗਦੀ ਹੈ ਫੈਕਟਰੀ ਲੱਗਣ ਦੇ ਲਈ ਕਿਆ ਹੁੰਦਾ ਹੈ ਕਿ ਉੱਥੇ ਉਸ ਜਗ੍ਹਾ ਦੇ ਉੱਤੇ ਜਿਹੜੇ ਬ ਬੂਟੇ ਹੁੰਦੇ ਆ ਦਰਖਤ ਹੁੰਦੇ ਆ ਉਹਨਾਂ ਨੂੰ ਵੱਢ ਦਿੱਤਾ ਜਾਂਦਾ ਹੈ ਜੰਗਲਾਂ ਨੂੰ ਵੱਢ ਦਿੱਤਾ ਜਾਂਦਾ ਹੈ ਜੰਗਲਾਂ ਨੂੰ ਵੱਢਣ ਦੇ ਨਾਲ ਕਿਆ ਹੁੰਦਾ ਹੈ ਜਿਹੜਾ ਆ ਉੱਥੇ ਦਾ ਮਤਲਬ ਹਰਿਆਲੀ ਹੁੰਦੀ ਆ ਉਹ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਅਤੇ ਜਿਹੜੀ ਆਕਸੀਜਨ ਦਾ ਲੈਵਲ ਤਾਂ ਆਪਣੇ ਆਪ ਹੀ ਘੱਟਣਾ ਹੀ ਹੈ ਜਿਵੇਂ ਕਿ ਜਦੋਂ ਅਸੀਂ ਦਰੱਖਤਾਂ ਨੂੰ ਕੱਟਾਂਗੇ ਇਸ ਤਰ੍ਹਾਂ ਜਿਹੜਾ ਸਾਡੇ ਵਾਤਾਵਰਨ 'ਤੇ ਪ੍ਰਭਾਵ ਵੀ ਪੈਂਦਾ ਹੈ ਅਤੇ ਫੈਕਟਰੀਆਂ ਤੋਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਫੈਕਟਰੀਆਂ ਤੋਂ ਨਿਕਲਣ ਵਾਲਾ ਪਾਣੀ ਪਾਣੀ ਵੀ ਗੰਦਾ ਹੁੰਦਾ ਹੈ ਅਤੇ ਪਾਣੀ ਗੰਦੇ ਇਹ ਪਾਣੀ ਸਾਫ ਪਾਣੀ ਦੇ ਵਿੱਚ ਮਿਲ ਕੇ ਉਹ ਲੋਕਾਂ ਨੂੰ ਪੀਣ ਦੇ ਵਿੱਚ ਉਹੀ ਪਾਣੀ ਕਈ ਵਾਰੀ ਆ ਜਾਂਦਾ ਕਿਉਂਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਫਿਲਟਰ ਮੌਜੂਦ ਹੁੰਦੇ ਹਨ ਪਰੰਤੂ ਪਿੰਡਾਂ ਦੇ ਵਿੱਚ ਫਿਲਟਰ ਪਾਣੀ ਕਿਸੇ ਕਿਸੇ ਘਰ ਦੇ ਵਿੱਚ ਹੀ ਹੁੰਦਾ ਹੈ ਅਤੇ ਉਹ ਲੋਕ ਉਹ ਗੰਦਾ ਪਾਣੀ ਹੀ ਪੀ ਲੈਂਦੇ ਹਨ ਜਿਸ ਕਰਕੇ ਬਿਮਾਰੀਆਂ ਤਾਂ ਉਹਨਾਂ ਨੂੰ ਲੱਗਦੀਆਂ ਹੀ ਹਨ ਇਸ ਤਰ੍ਹਾਂ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦੀ ਹਾਂ ਕਿ ਜਿਹੜੀਆਂ ਵਪਾਰਕ ਖੇਤਰ ਹੈ ਇਹ ਸਮਾਜਿਕ ਤੌਰ 'ਤੇ ਮਤਲਬ ਵਧੀਆ ਪ੍ਰਭਾਵ ਵੀ ਲੈ ਕੇ ਆਇਆ ਹੈ ਇਹਨੇ ਲੋਕਾਂ ਨੂੰ ਸੰਬੋਧਿਤ ਕੀਤਾ ਆ ਆਪਣੇ ਵੱਲ ਲੋਕਾਂ ਨੂੰ ਆਪਣੇ ਵੱਲ ਜਾਗਰੂਕ ਕੀਤਾ ਹੈ ਆਪਣੇ ਵੱਲ ਸੰਬੋਧਿਤ ਕੀਤਾ ਹੈ ਪਰੰਤੂ ਇਹਨਾਂ ਨੇ ਵਾਤਾਵਰਨ ਦੇ ਉੱਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਹੈ